ਪੇਂਟਿੰਗ ਬਣਾਉਣ ਦੇ ਵਿੱਚ ਜੋ ਸਹੀ ਅਧਿਕਤਮ ਮੁਸ਼ਕਲ ਮੈਨੂੰ ਹੋਈ ਹੈ ਉਹ ਪੇਂਟਿੰਗ ਦੇ ਇਕਵਿਪਮੈਂਟਸ ਇਕੱਠੇ ਕਰਨ ਦੇ ਵਿੱਚ ਹੋਈ ਹੈ ਪੇਂਟਿੰਗ ਦੇ ਸਹੀ ਪੇਂਟਿੰਗ ਬਣਾਉਣ ਵਾਸਤੇ ਅਤੇ ਸਟੀਕ ਪੇਂਟਿੰਗ ਬਣਾਉਣ ਵਾਸਤੇ ਸਹੀ ਇਕਿਪਮੈਂਟਸ ਦਾ ਹੋਣਾ ਬਹੁਤ ਜ਼ਰੂਰੀ ਹੈ ਜਿਵੇਂ ਕਿ ਸਹੀ ਬ੍ਰਸ਼ ਹੋਣੇ ਬਹੁਤ ਜ਼ਰੂਰੀ ਹੈ ਸਹੀ ਪੇਂਟ ਹੋਣਾ ਬਹੁਤ ਜ਼ਰੂਰੀ ਹੈ ਅਤੇ ਸਹੀ ਸ਼ੀਟ ਜਿਸ ਤੇ ਤੁਸੀਂ ਪੇਂਟਿੰਗ ਬਣਾਉਣੀ ਹੈ ਉਹ ਬਹੁਤ ਜ਼ਰੂਰੀ ਹੈ ਕਈ ਵਾਰ ਕੀ ਹੁੰਦਾ ਸੀ ਮੈਂ ਆਪਣੇ ਸ਼ਹਿਰ ਦੇ ਵਿੱਚ ਸਾਰੇ ਸ਼ਹਿਰ ਦੇ ਵਿੱਚ ਭਕਾਈ ਕਰਕੇ ਵੀ ਸਹੀ ਮਟੀਰੀਅਲ ਨਹੀਂ ਲੈ ਪਾਉਂਦਾ ਸੀ ਕਈ ਵਾਰ ਉਹ ਮਟੀਰੀਅਲ ਮੇਰੇ ਬਜਟ ਤੋਂ ਕਾਫੀ ਜ਼ਿਆਦਾ ਮਹਿੰਗਾ ਸੀ ਤਾਂ ਇਸ ਕਰਕੇ ਮੈਨੂੰ ਉਸ ਦੇ ਵਿੱਚ ਕਾਫੀ ਪਰੇਸ਼ਾਨੀ ਹੁੰਦੀ ਸੀ ਫਿਰ ਮੈਂ ਹੌਲੀ ਹੌਲੀ ਪੈਸੇ ਇਕੱਠੇ ਕਰਕੇ ਉਸ ਮਟੀਰੀਅਲ ਨੂੰ ਔਨਲਾਈਨ ਮੰਗਵਾਉਂਦਾ ਸੀ ਜਿਸ ਨਾਲ ਮੇਰਾ ਦੋ ਰੁਪਈਆਂ ਦਾ ਫਾਇਦਾ ਵੀ ਹੁੰਦਾ ਸੀ ਅਤੇ ਭਾਵੇਂ ਕਿ ਔਨਲਾਈਨ ਮੈਨੂੰ ਕਾਫੀ ਦੇਰ ਦੇ ਨਾਲ ਉਹ ਮਟੀਰੀਅਲ ਮਿਲਦਾ ਸੀ ਪਰ ਫਿਰ ਵੀ ਮੈਂ ਹਾਰ ਨਹੀਂ ਮੰਨੀ ਇਸ ਦੇ ਵਿੱਚ ਮੈਨੂੰ ਪ੍ਰੇਰਨਾ ਦੀ ਘਾਟ ਮਹਿਸੂਸ ਨਹੀਂ ਹੋਈ ਕਿਉਂਕਿ ਮੇਰੀ ਫੈਮਿਲੀ ਦੀ ਮੈਨੂੰ ਕਾਫੀ ਜ਼ਿਆਦਾ ਸਪੋਰਟ ਸੀ ਤਾਂ ਉਸ ਕਰਕੇ ਮੈਨੂੰ ਮੈਂ ਹਮੇਸ਼ਾ ਪ੍ਰੇਰਿਤ ਰਹਿੰਦਾ ਸੀ ਅਤੇ ਹਮੇਸ਼ਾ ਡੈਡੀਕੇਟਡ ਰਹਿੰਦਾ ਸੀ ਆਪਦੀ ਪੇਂਟਿੰਗ ਨੂੰ ਲੈ ਕੇ ਅਤੇ ਮੈਂ ਹਮੇਸ਼ਾ ਸੈਟਿਸਫਾਈ ਰਹਿੰਦਾ ਸੀ